ਖੇਤੀਬਾੜੀ ਕਿਸਾਨਾਂ ਦਾ ਮੁੱਖ ਕਿੱਤਾ ਹੈ ਜਿਸ ਨੂੰ ਕਿਸਾਨ ਆਪਣਾ ਘਰ ਬਾਰ ਚਲਾਉਣ ਲਈ ਘਰ ਚੰਗੀ ਤਰ੍ਹਾਂ ਚਲਾਉਣ ਲਈ ਕਰਦੇ ਹਨ ਕਿਸਾਨਾਂ ਮਤਲਬ ਖੇਤੀਬਾੜੀ ਵਿਭਿੰਨਤਾ ਉਤਸ਼ਾਹ ਪ੍ਰੋਜੈਕਟ ਇੱਕ ਇਹੋ ਜਿਹਾ ਪ੍ਰੋਜੈਕਟ ਹੈ ਜਿਸ ਨੂੰ ਕਿਸਾਨ ਬੜੇ ਉਤਸ਼ਾਹ ਨਾਲ ਕਰਦੇ ਹਨ ਅੱਜ ਕੱਲ੍ਹ ਜਿਹੜੇ ਕਿਸਾਨ ਹਨ ਉਹਨਾਂ ਨੂੰ ਮੋਦੀ ਮਤਲਬ ਆਪਣੇ ਪ੍ਰਧਾਨ ਮੰਤਰੀ ਜੀ ਜੋ ਹਨ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਸਪੈਸ਼ਲ ਸਕੀਮ ਦੇ ਤਹਿਤ ਕਿਸਾਨਾਂ ਨੂੰ ਸਹਾਇਕ ਰਕਮ ਦਿੱਤੀ ਜਾ ਰਹੀ ਹੈ ਉਹ ਜਿਹੜੀ ਹੈ ਮਤਲਬ ਕਿ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਚਾਰ ਮਹੀਨਿਆਂ ਦਾ ਦੋ ਹਜ਼ਾਰ ਦਿੰਦੇ ਹਨ ਅਤੇ ਜਿਹੜੇ ਕਿ ਆਹ ਛੇ ਸਾਲ ਦਾ ਪੂਰਾ ਦੇ ਦਿੰਦੇ ਹਨ ਕਿ ਮਤਲਬ ਇਹ ਮੰਨ ਲਓ ਤੁਸੀਂ ਛੇ ਹਜ਼ਾਰ ਬਣ ਜਾਂਦਾ ਹੈ ਜੇ ਮਤਲਬ ਕਿਸਾਨ ਕਿਸਾਨ ਖੇਤੀਬਾੜੀ ਇਸ ਤਰ੍ਹਾਂ ਕਰਦੇ ਹਨ ਇਸ ਨਾਲ ਹੀ ਮਤਲਬ ਆਪਣੇ ਘਰਾਂ ਵਿੱਚ ਕਣਕ ਜੌਂ ਚਾਵਲ ਅਤੇ ਹੋਰ ਜਿਹੜੇ ਫ਼ਸਲਾਂ ਹਨ ਪਹੁੰਚਦੀਆਂ ਹਨ ਜੋ ਕਿ ਆਪਾਂ ਨੂੰ ਜ਼ਰੂਰੀ ਹਨ ਅਤੇ ਆਪਾਂ ਕਿਸਾਨਾਂ ਵੱਲੋਂ ਲੈ ਸਕਦੇ ਹਾਂ